ਹਾਂਜੀ ਸਾਡੇ ਇਲਾਕੇ ਦੇ ਵਿੱਚ ਆਮਦਨ ਦਾ ਮੁੱਖ ਸਰੋਤ ਤਾਂ ਖੇਤੀਬਾੜੀ ਹੈ ਪੰਜਾਬ ਦੇ ਵਿੱਚ ਮੇਰੇ ਖੇਤਰ ਅਤੇ ਮੇਰੇ ਇਲਾਕਿਆਂ ਦੇ ਵਿੱਚ ਵੀ ਅਤੇ ਦੂਜੇ ਨੰਬਰ 'ਤੇ ਜੇ ਅਸੀਂ ਕਹਿ ਲਈਏ ਕਿ ਆ ਦੁਕਾਨਦਾਰੀ ਜਿਹੜੀ ਹੈਗੀ ਹੈ ਮਤਲਬ ਕਿ ਦੁਕਾਨਾਂ ਨੇ ਬਾਜ਼ਾਰ ਆ ਜਿਹੜਾ ਉਹਦੇ ਵਿੱਚ ਵੱਖੋ ਵੱਖ ਕਿਸਮ ਦੀਆਂ ਦੁਕਾਨਾਂ ਨੇ ਵੱਖੋ ਵੱਖ ਸਮਾਨ ਦੀਆਂ ਉਹਦੇ ਵਿੱਚ ਵੀ ਉਹ ਵੀ ਇੱਕ ਆਮਦਨ ਦਾ ਅੱਛਾ ਸਰੋਤ ਚੰਗਾ ਸਰੋਤ ਹੈਗਾ ਇੱਥੇ ਅਤੇ ਜਾਂ ਸਰਵਿਸਿਜ਼ ਦਾ ਖੇਤਰ ਹੈਗਾ ਲੋਕ ਨੌਕਰੀਆਂ ਕਰਦੇ ਹੈਗੇ ਨੇ ਉਹਦੇ ਰਾਹੀਂ ਉਹਨਾਂ ਨੂੰ ਆਮਦਨ ਹੁੰਦੀ ਹੈਗੀ ਹੈ ਤਾਂ ਜ਼ਿਆਦਾਤਰ ਇੱਥੇ ਖੇਤੀਬਾੜੀ ਦੁਕਾਨਦਾਰੀ ਅਤੇ ਸਰਵਿਸਿਜ਼ ਦੇ ਖੇਤਰ ਦੇ ਵਿੱਚ ਨੌਕਰੀਆਂ ਤੋਂ ਆਮਦਨ ਜਿਹੜੀ ਉਹ ਹੈਗੀ ਆ ਸਾਡੇ ਇਲਾਕੇ ਦੇ ਵਿੱਚ ਹਾਂਜੀ